ਮੇਰੀ ਮੇਰੇ ਸ਼ੌਂਕ ਨੇ ਕ੍ਰਿਕਟ ਖ ਗੇਮ ਦੇ ਵਿੱਚ ਮੈਂ ਕ੍ਰਿਕਟ ਖੇਡਣਾ ਮੈਨੂੰ ਪਸੰਦ ਹੈ ਕ੍ਰਿਕਟ ਮੈ ਸ਼ ਕੋਲਜ ਸਕੂਲ ਟਾਈਮ ਤੋਂ ਹੀ ਖੇਲਦਾ ਆ ਰਿਹਾ ਹਾਂ ਕੋਲਜ ਦੇ ਵਿੱਚ ਮੈਂ ਸਟੇਟ ਲੈਵਲ 'ਤੇ ਕ੍ਰਿਕਟ ਖੇਡਿਆ ਹੋਇਆ ਹੈ ਕ੍ਰਿਕਟ ਦੇ ਨਾਲ਼ ਕ੍ਰਿਕਟ ਦੇ ਨਾਲ਼ ਨਾਲ਼ ਮੈਨੂੰ ਜਿੰਮ ਕਰਨ ਦਾ ਬਹੁਤ ਸ਼ੌਂਕ ਹੈ ਅਤੇ ਘੁੰਮਣ ਦਾ ਬਹੁਤ ਸ਼ੌਂਕ ਹੈ ਜਿੰਮ ਦੇ ਵਿੱਚ ਜਿੰਮ ਮੈਂ ਸਾਡੇ ਘਰ ਦੇ ਕੋਲ਼ ਹੀ ਮੌਜੂਦ ਹੈ ਉੱਥੇ ਮੈਂ ਹਫਤੇ ਵਿੱਚ ਚਾਰ ਦਿਨ ਜਿੰਮ ਕਰਨ ਜਾਂਦਾ ਹਾਂ ਜਿੰਮ ਕਰਨ ਜਾਂਦਾ ਹਾਂ ਬਹੁਤ ਹੀ ਜਿੰਮ ਸਾਡੀ ਜਿਵੇਂ ਇਹ ਬਹੁਤ ਹੀ ਜਿੰਮ ਸਾਫ਼ ਸੁਥਰੀ ਹੈ ਇੱਥੇ ਕੋ ਕੋਚ ਦੋ ਕੋਚ ਰੱਖੇ ਹੋਏ ਨੇ ਜੋ ਸਾਨੂੰ ਜਿੰਮ ਕਰਨ ਵਿੱਚ ਜਾਂ ਸਹਾਇਤਾ ਕਰਦੇ ਹਨ ਸਪੋਟ ਕਰਦੇ ਹਨ ਅਤੇ ਦੱਸਦੇ ਹਨ ਵੀ ਕਿਵੇਂ ਕਿਵੇਂ ਤੁਸੀਂ ਕਿਸ ਮ ਕਿਸ ਮਸਲ ਲਈ ਕਿਆ ਜ ਕਿਹੜੀ ਕੋ ਕਿਹੜੀ ਜਿੰਮ ਲਾਉਣੀ ਹੈ ਜਿੰਮ ਦੇ ਨਾਲ਼ ਨਾਲ਼ ਫਿਰ ਡਾਇਟ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਤਾਂ ਜੋ ਸਰੀਰ ਸਰੀਰ ਨੂੰ ਸੈੱਟ ਕਰਿਆ ਸੈੱਟ ਰੱਖਿਆ ਜਾ ਸਕੇ ਅਤੇ ਘੁੰਮਣ ਫਿਰਨ ਦਾ ਵੀ ਬਹੁਤ ਸ਼ੌਂਕ ਹੈ ਪਿਛਲੇ ਪਿਛਲੇ ਮਹੀਨੇ ਮੈਂ ਡੁਬਈ ਘੁੰਮ ਕੇ ਆਇਆ ਉੱਥੇ ਜਾ ਕੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਹੀ ਚੰਗਾ ਸ਼ਹਿਰ ਹੈ ਉੱਥੇ ਦੇ ਰੂਲ ਨਿਯਮ ਬਹੁਤ ਹੀ ਸਹੀ ਹਨ ਅਤੇ ਲੋਕ ਬਹੁਤ ਚੰਗੇ ਹਨ ਮਦਦ ਕਰਨ ਵਾਲ਼ੇ ਹਨ ਉੱਥੇ ਮੈਂ ਇੱਕ ਹਫਤਾ ਲਾ ਕੇ ਆਇਆ ਸੀਗਾ ਅਤੇ ਇੱਕ ਹਫ਼ਤਾ ਲਾ ਕੇ ਆਇਆ ਸੀਗਾ ਉੱਥੇ ਮੈਂ ਹੋਟਲ ਦੇ ਵਿੱਚ ਰਿਹਾ ਅਤੇ ਬਹੁ ਉਹ ਹੋਟਲ ਬਹੁਤ ਹੀ ਚੰਗਾ ਅਤੇ ਵਧੀਆ ਸੀਗਾ ਸਾਫ਼ ਸੁਥਰਾ ਸੀਗਾ ਉੱਥੋਂ ਦਾ ਸਟਾਫ ਬਹੁਤ ਹੀ ਮਿਲਣਸਾਰ ਸੀ ਚੰਗੀ ਤਰ੍ਹਾਂ ਉਹਨਾਂ ਨੇ ਸਾਨੂੰ ਗਾਈਡ ਕੀਤਾ ਤਾਂ ਇੱਥੋਂ ਅਤੇ ਏ ਜਿੱਥੇ ਜਿੱਥੇ ਅਸੀਂ ਘੁੰਮਣ ਜਾਣਾ ਸੀਗਾ ਉੱਥੇ ਉੱਥੇ ਸਾਨੂੰ ਉਹਨਾਂ ਨੇ ਪ੍ਰੋਪਰ ਗਾਈਡ ਕੀਤਾ ਕਿ ਤੁਸੀਂ ਇੱਥੋਂ ਮੈਟਰੋ ਲਓ ਉੱਥੇ ਜਾ ਕੇ ਇਹ ਮੋਲ ਲਈ ਘੁੰਮੋ ਇੱਥੇ ਡੈਟਰ ਸਪਾਰੀ ਕਰਨ ਜਾਓ ਤੁਸੀਂ ਉੱਥੇ ਅਸੀਂ ਐਨ ਬਹੁਤ ਹੀ ਇੰਜੋਏ ਕੀਤਾ ਅਲੱਗ ਅਲੱਗ ਜੰਬ 'ਤੇ ਘੁੰਮ ਕੇ ਆਏ ਅਤੇ ਇੱਕ ਹਫਤੇ ਬਾਅਦ ਅਸੀਂ ਵਾਪਸ ਆਏ ਅਤੇ ਇੱਥੇ ਵੀ ਮੈਂ ਪੀ ਉਸ ਤੋਂ ਬਾਅਦ ਮੈਂ ਰਾਜਸਥਾਨ ਘੁੰਮਣ ਗਿਆ ਹਾਂ ਜੈਪੁਰ ਘੁੰਮਣ ਗਿਆ ਇਹ ਵੀ ਬਹੁਤ ਹੀ ਬਹੁਤ ਚੰਗੇ ਇਲਾਕੇ ਹਨ ਘੁੰਮਣ ਫਿਰਨ ਦੇ ਲਈ ਘੁੰਮਣਾ ਫਿਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਬੰਦਾ ਸਟ੍ਰੈਸ ਫ੍ਰੀ ਰਹਿ ਸਕੇ